ਡਾਂਸ ਇੱਕ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿੱਥੇ ਮਤਲਬ ਖਲੋਤੇ ਖਲੋਤੇ ਵੀ ਦਿਲ ਕਰਦਾ ਕਿ ਭੰਗੜਾ ਪਾਈਏ ਜ਼ਰੂਰੀ ਨਹੀਂ ਕਿ ਹਰ ਇੱਕ ਇੰਗਲਿਸ਼ ਗਾਣੇ ਜਾਂ ਕੋਈ ਹੋਰ ਗਰਬੇ ਉੱਤੇ ਮਤਲਬ ਡਾਂਸ ਕੀਤਾ ਜਾਵੇ ਸੱਭਿਆਚਾਰ ਜਿਵੇਂ ਭੰਗੜਾ ਹੋ ਗਿਆ ਭੰਗੜਾ ਲੈ ਲਉ ਜਾਂ ਬੋਲੀਆਂ ਲੈ ਲਉ ਜਾਂ ਗਿੱਧਾ ਲੈ ਲਉ ਉਹ ਚੀਜ਼ ਨੂੰ ਵੀ ਇਕੱਠਾ ਕੀਤਾ ਜਾਂਦਾ ਹੈ ਕਿਉਂਕਿ ਅਗਰ ਇੱਕ ਇਨਸਾਨ ਭੰਗੜਾ ਪਾ ਰਿਹਾ ਅਤੇ ਦੂਜੇ ਦਾ ਮਨ ਆਪੇ ਕਰਨਾ ਕਿ ਮੈਂ ਇਹਦੇ ਕੋਲ ਜਾ ਕੇ ਭੰਗੜਾ ਮੈਂ ਵੀ ਇਹੋ ਜਿਹਾ ਪਾਵਾਂ ਅਤੇ ਇਸ ਕਰਕੇ ਜਿਹੜਾ ਸੱਭਿਆਚਾਰ ਹੈ ਅੱਜ ਵੀ ਕਿਤੇ ਨਾ ਕਿਤੇ ਮੌਜੂਦ ਹੈਗਾ ਹੈ ਲੋਕ ਅੱਜ ਵੀ ਕਿਤੇ ਕਿਤੇ ਨਾ ਪਿੰਡਾਂ ਵਿੱਚ ਜਿਵੇਂ ਕਿ ਬੋਲੀਆਂ ਪਾਉਂਦੇ ਨੇ ਗਿੱਧਾ ਪਾਉਂਦੇ ਨੇ ਇੰਗਲਿਸ਼ ਗਾਣੇ ਜਾਂ ਪੰਜਾਬੀ ਗਾਣੇ ਜ਼ਰੂਰੀ ਨਹੀਂ ਇਹਨਾਂ 'ਤੇ ਹੀ ਭੰਗੜਾ ਪਾਇਆ ਜਾ ਸਕਦਾ ਕੋਈ ਹੋਰ ਚੀਜ਼ ਵੀ ਹੋਵੇ ਜਾਂ ਆਪਾਂ ਕਿਸੇ ਹੋਰ ਦੇਸ਼ ਵਿੱਚ ਜਾ ਕੇ ਵੀ ਅਸੀਂ ਉਹਨਾਂ ਦਾ ਡਾਂਸ ਵਗੈਰਾ ਵੀ ਜਦੋਂ ਕਰੀਏ ਜਦੋਂ ਅਸੀਂ ਆਪਣਾ ਭੰਗੜਾ ਪਾਉਂਦੇ ਹਾਂ ਉਹ ਸਾਡੇ ਕੋਲ ਸਿੱਖਦੇ ਨੇ ਕਿ ਸਾਨੂੰ ਵੀ ਇੱਦਾਂ ਦਾ ਡਾਂਸ ਸਿਖਾਉ ਅਸੀਂ ਵੀ ਇੱਦਾਂ ਦਾ ਗਿੱਧਾ ਜਾਂ ਭੰਗੜਾ ਪਾਉਣਾ ਚਾਹੁੰਦੇ ਹਾਂ ਦੂਰੋਂ ਦੂਰੋਂ ਲੋਕ ਆ ਕੇ ਮਤਲਬ ਇਹ ਚੀਜ਼ ਨੂੰ ਸੱਭਿਆਚਾਰ ਨੂੰ ਕਈ ਕਈਆਂ ਦੇਸ਼ਾਂ ਵਿੱਚ ਸੱਭਿਆਚਾਰ ਨੂੰ ਮਤਲਬ ਕੁਝ ਸਮਝਿਆ ਹੀ ਨਹੀਂ ਜਾਂਦਾ ਬਟ ਜਦੋਂ ਇੱਥੇ ਆ ਕੇ ਲੋਕ ਵੇਖਦੇ ਨੇ ਕਿ ਸੱਭਿਆਚਾਰ ਬਹੁਤ ਵਧੀਆ ਚੱਲ ਰਿਹਾ ਭੰਗੜਾ ਜਿਵੇਂ ਗਿੱਧਾ ਉਹ ਵੀ ਇਹ ਚੀਜ਼ਾਂ ਨੂੰ ਸਿੱਖਣਾ ਚਾਹੁੰਦੇ ਨੇ ਆਪਣੇ ਦੇਸ਼ ਉੱਤੇ ਮਤਲਬ ਚਲਾਉਣਾ ਚਾਹੁੰਦੇ ਨੇ ਸੱਭਿਆਚਾਰ ਇੱਕ ਇਹੋ ਜਿਹੀ ਚੀਜ਼ ਜਿੱਥੇ ਜਿੱਥੇ ਮਰਜ਼ੀ ਖਲੋਤੇ ਖਲੋਤੇ ਡਾਂਸ ਕਰੋ ਅਤੇ ਲੋਕ ਆਪਣੇ ਆਪ ਹੀ ਇਕੱਠੇ ਹੋ ਜਾਂਦੇ ਨੇ ਗਿ ਭੰਗੜੇ ਵਿੱਚ ਜਾਂ ਢੋਲ ਦੀ ਧੁੰਨ ਵਿੱਚ ਬੋਲੀਆਂ ਦੀ ਧੁੰਨ ਵਿੱਚ ਕਈ ਮਤਲਬ ਜਨਾਨੀਆਂ ਆ ਕੇ ਗਿੱਧਾ ਪਾਉਣ ਲੱਗ ਪੈਂਦੀਆਂ ਨੇ ਕੋਈ ਬੋਲੀਆਂ 'ਤੇ ਆ ਕੇ ਪਾਉਂਦੀਆਂ ਹਨ ਇਸ ਕਰਕੇ ਆਪਣੇ ਆਪ ਹੀ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਨੇ ਇਹ ਸੱਭਿਆਚਾਰ ਹੀ ਇੱਦਾਂ ਦਾ